ਹਾਂ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਮੈਨੂੰ ਖਾਣਾ ਖਾਣਾ ਵਗੈਰਾ ਬਣਾਉਣਾ ਬਹੁਤ ਵਧੀਆ ਲੱਗਦਾ ਹੈ ਜੋ ਕਿ ਸਭ ਤੋਂ ਪਹਿਲਾਂ ਮੈਨੂੰ ਇਹ ਇਸ ਚੀਜ਼ ਦਾ ਹੁਨਰ ਉਦੋਂ ਤੋਂ ਆਇਆ ਵੀ ਜਦੋਂ ਮੈਂ ਮਤਲਬ ਕਦੇ ਘਰੇ ਮੇਰੀ ਮੰਮੀ ਸਬਜ਼ੀ ਬਹੁ ਸਬਜ਼ੀ ਵਗੈਰਾ ਬਣਾਉਂਦੇ ਅਤੇ ਖਾਣਾ ਟੇਸਟੀ ਬਣਾਉਂਦੇ ਹੈ ਪਰ ਹੁਣ ਵਿੱਚ ਵਿੱਚ ਕਈ ਵਾਰੀ ਕੁਛ ਇੱਦਾਂ ਦਾ ਵੀ ਸਬਜ਼ੀਆਂ ਵਗੈਰਾ 'ਚ ਟੀਕੇ ਵਗੈਰਾ ਲੱਗ ਰਹੇ ਹੈ ਜਾਂ ਫਿਰ ਕੁਛ ਹੋਰ ਮਤਲਬ ਮਸਾਲੇ ਮਸੁਲੇ ਠੀਕ ਨਹੀਂ ਆ ਰਹੇ ਜਿਸ ਕਰਕੇ ਅੱਜਕੱਲ੍ਹ ਸਬਜ਼ੀ ਸਵਾਦ ਨਹੀਂ ਲੱਗਦੀ ਪਰ ਫਿਰ ਮੈਂ ਕਿਆ ਕਰਦਾ ਹਾਂ ਮੈਂ ਉਹਨਾਂ ਵਿੱਚ ਜਿਹੜੀ ਸਬਜ਼ੀ ਬਣੀ ਬਣਾਈ ਹੁੰਦੀ ਹੈ ਉਹਦੇ ਵਿੱਚ ਕੁਛ ਹੋਰ ਸ ਮਸਾਲੇ ਵਗੈਰਾ ਐਡ ਕਰਕੇ ਉਸਨੂੰ ਹੋਰ ਵਧੀਆ ਖਾਣ ਲਾਇਕ ਬਣਾ ਦਿੰਦਾ ਹਾਂ ਜਿਸ ਕਰਕੇ ਮੇਰੀ ਮਾਤਾ ਜੀ ਵੀ ਖਾਣ ਨੂੰ ਵੀ ਵਧੀਆ ਖਾਣਾ ਵਧੀਆ ਕਹਿੰਦੇ ਹਨ ਅਤੇ ਉਹ ਕਹਿੰਦੇ ਹਨ ਕਿ ਤੂੰ ਮੇਰੇ ਨਾਲੋਂ ਵੀ ਵਧੀਆ ਬਣਾ ਲੈਂਦਾ ਹੈ